ਜੇਕਰ ਮੈਂ ਆਪਣੇ ਮਨਪਸੰਦ ਖੇਡ ਦੀ ਗੱਲ ਕਰਾਂ ਤਾਂ ਮੇਰਾ ਮਨਪਸੰਦ ਖੇਡ ਕ੍ਰਿਕਟ ਹੈ ਇਹ ਇੱਕ ਟੀਮ ਗੇਮ ਹੈ ਇਸ ਵਿੱਚ ਦੋ ਟੀਮਾਂ ਹੁੰਦੀਆਂ ਹਨ ਇਹ ਦੋ ਟੀਮਾਂ ਤੋਂ ਬਗੈਰ ਨਹੀਂ ਆਪਾਂ ਖੇਡ ਸਕਦੇ ਦੋਨਾਂ ਟੀਮਾਂ ਦੇ ਕੋਲ ਗਿਆਰ੍ਹਾਂ ਗਿਆਰ੍ਹਾਂ ਪਲੇਅਰ ਹੁੰਦੇ ਹਨ ਜਿਹੜੇ ਕਿ ਖੇਡਦੇ ਹਨ ਗਿਆਰ੍ਹਾਂ ਗਿਆਰ੍ਹਾਂ ਪਲੇਅਰਾਂ ਵਿੱਚੋਂ ਇੱਕ ਬੋਲ ਨੂੰ ਮਾਰਨ ਵਾਲਾ ਹੁੰਦਾ ਹੈ ਜਿਸ ਕੋਲ ਬੱਲਾ ਹੁੰਦਾ ਹੈ ਅਤੇ ਦੂਸਰਾ ਇੱਕ ਬੋਲਰ ਹੁੰਦਾ ਹੈ ਜੋ ਕਿ ਬੋਲ ਨੂੰ ਸੁੱਟਦਾ ਹੈ ਜੋ ਕਿ ਦੂਸਰੀ ਟੀਮ ਦਾ ਹੁੰਦਾ ਹੈ ਅਤੇ ਇੱਕ ਵਿਕਟ ਕੀਪਰ ਹੁੰਦਾ ਹੈ ਓਹ ਵੀ ਦੂਸਰੀ ਟੀਮ ਦਾ ਹੀ ਬੰਦਾ ਹੁੰਦਾ ਹੈ ਅਤੇ ਇਹ ਜਿਹੜਾ ਗੇਮ ਹੈ ਉਹ ਇੱਕ ਗੋਲ ਵੱਡੇ ਸਾਰੇ ਸਰਕਲ ਦੇ ਵਿੱਚ ਖੇਡਿਆ ਜਾਂਦਾ ਹੈ ਇੱਕ ਬਾਊਂਡਰੀ ਜੀ ਬਣਾਈ ਜਾਂਦੀ ਹੈ ਜਿਹੜੀ ਕੀ ਮੈਦਾਨ ਦੇ ਵਿੱਚ ਗੋਲ ਆਕਾਰ ਦੀ ਹੁੰਦੀ ਹੈ ਅਤੇ ਇਸ ਦੇ ਸੈਂਟਰ ਦੇ ਵਿੱਚ ਇੱਕ ਹੋਰ ਗੋਲ ਚੱਕਰ ਹੁੰਦਾ ਹੈ ਜਿਸ ਦੇ ਉੱਤੇ ਪਲੇਅਰ ਆਪਣੀ ਪਜੀਸ਼ਨ ਵਗੈਰਾ ਲੈਂਦੇ ਨੇ ਅਤੇ ਉਸ ਪਜੀਸ਼ਨ ਦੇ ਵਿੱਚ ਹੀ ਖਲੋ ਕੇ ਆਪਣੀ ਬੋਲ ਨੂੰ ਸੁੱਟਦੇ ਨੇ ਅਤੇ ਹਿੱਟ ਕਰਦੇ ਨੇ ਅਤੇ ਇਸ ਖੇਡ ਦੇ ਵਿੱਚ ਸਾਰੀਆਂ ਹੀ ਖਿਡਾਰੀਆਂ ਦੀ ਬੜੀ ਹੀ ਅਹਿਮ ਭੂਮਿਕਾ ਹੈ ਕਿਸੇ ਨੇ ਬੋਲ ਨੂੰ ਕੈਚ ਕਰਨਾ ਹੁੰਦਾ ਹੈ ਅਤੇ ਕਿਸੇ ਨੇ ਬੋਲ ਨੂੰ ਰੋਕਣਾ ਹੁੰਦਾ ਹੈ ਕਿਸੇ ਨੇ ਬੋਲ ਨੂੰ ਸੁੱਟਣਾ ਹੁੰਦਾ ਹੈ ਅਤੇ ਕਿਸੇ ਨੇ ਬੈਟ ਨਾਲ ਬੋਲ ਨੂੰ ਧੱਕਾ ਮਾਰਨਾ ਹੁੰਦਾ ਹੈ ਅਤੇ ਇਸ ਵਿੱਚ ਬਚਾਅ ਲਈ ਖੇਡ ਖੇਡ ਦੌਰਾਨ ਬਚਾਅ ਲਈ ਲੈੱਗ ਗਾਰਡ ਹੈਂਡ ਗਾਰਡ ਹੈਲਮਟ ਵਗੈਰਾ ਵੀ ਪਹਿਨਿਆ ਜਾਂਦਾ ਹੈ